ਅੱਜ ਦੇ ਸਮੇਂ ਵਿੱਚ ਖੇਤੀ ਤਕਨੀਕਾਂ ਵਿੱਚ ਖੇਤੀਬਾੜੀ ਤਕਨੀਕਾਂ ਵਿੱਚ ਬਹੁਤ ਤਬਦੀਲੀ ਆਈ ਹੈ ਅੱਜ ਦੇਖਣ ਯੋਗ ਹੀ ਹੈਗੀ ਅੱਜ ਦੇ ਸਮੇਂ ਵਿੱਚ ਖੇਤੀ ਤਕਨੀਕ ਬਹੁਤ ਬਦਲ ਚੁੱਕੀਆਂ ਹਨ ਪੁਰਾਣੇ ਸਮੇਂ ਵਿੱਚ ਕਿਸਾਨ ਹੱਲਾਂ ਦੇ ਨਾਲ ਅਤੇ ਬਲਦਾਂ ਦੇ ਨਾਲ ਖੇਤੀ ਵਾਹੁੰਦੇ ਸਨ ਅਤੇ ਫਿਰ ਫਸਲ ਬੀਜ ਕੇ ਅਤੇ ਹੱਥਾਂ ਨਾਲ ਕਟਾਈ ਕਰਕੇ ਫਿਰ ਮੰਡੀ ਤੱਕ ਲਿਜਾਂਦੇ ਸਨ ਪਰ ਆਧੁਨਿਕ ਸਮੇਂ ਵਿੱਚ ਆਧੁਨਿਕ ਟੈਕਨੋਲੋਜੀ ਆਉਣ ਕਾਰਨ ਕਿਸਾਨ ਤੈਕਨੋਲਜੀ ਦਾ ਫਾਇਦਾ ਉਠਾਉਂਦੇ ਨੇ ਨਵੇਂ ਟਰੈਕਟਰਾਂ ਹੱਲਾਂ ਅਤੇ ਕੰਬਾਈਨ ਮਸ਼ੀਨਾਂ ਦੇ ਨਾਲ ਖੇਤੀ ਕਰਦੇ ਨੇ ਪਹਿਲਾਂ ਕਿਸਾਨ ਪੁਰਾਣੇ ਬੀਜ ਬੀਜਦੇ ਸਨ ਹੁਣ ਪਰ ਐਚ ਆਈ ਵੀ ਸੀਜ ਆ ਗਏ ਨੇ ਜਿਸ ਦਾ ਕਰਕੇ ਕਿ ਫਸਲਾਂ ਦੇ ਝਾੜ ਹੋਰ ਵੀ ਵਧੀਆ ਹੋ ਚੁੱਕਿਆ ਇਸ ਤੋਂ ਇਲਾਵਾ ਇਰੀਗੇਸ਼ਨ ਵਿੱਚ ਵੀ ਬਹੁਤ ਤਬਦੀਲੀ ਆਈ ਹੈ ਪੁਰਾਣੇ ਸਮੇਂ ਵਿੱਚ ਕਿਸਾਨ ਪ ਨਦੀਆਂ ਅਤੇ ਨਹਿਰਾਂ ਆਦਿ 'ਤੇ ਨਿਰਭਰ ਹੁੰਦੇ ਸਨ ਅਤੇ ਵਰਖਾ ਦੇ ਪਾਣੀ 'ਤੇ ਨਿਰਭਰ ਹੁੰਦੇ ਸਨ ਪਰ ਹੁਣ ਦੇ ਸਮੇਂ ਵਿੱਚ ਇਰੀਗੇਸ਼ਨ ਟੈਕਨੋਲੋਜੀ ਵਿੱਚ ਵੀ ਬਹੁਤ ਚੇਂਜ ਆਇਆ ਹੁਣ ਵਿੱਚ ਟੈ ਟਿਊਬਵੈੱਲਜ ਆ ਗਏ ਨੇ ਜਿਸ ਦਾ ਕਰਕੇ ਕਿਸਾਨਾਂ ਨੂੰ ਪਾਣੀ ਅਤੇ ਇਰੀਗੇਸ਼ਨ ਵਿੱਚ ਬਹੁਤ ਹੀ ਦਿੱਕਤ ਨਹੀਂ ਆਉਂਦੀ ਦੇਖਿਆ ਜਾਵੇ ਤਾਂ ਪੁਰਾਣੇ ਸਮੇਂ ਨਾਲੋਂ ਹੁਣ ਵਿੱਚ ਬਹੁਤ ਫਰਕ ਆ ਗਿਆ ਹੁਣ ਕਿਸਾਨਾਂ ਨੂੰ ਉਨੀ ਦਿੱਕਤ ਨਹੀਂ ਆਉਂਦੀ ਫਸਲ ਬੀਜਣ ਦੇ ਵਿੱਚ ਜਿੰਨਾਂ ਕਿ ਪੁਰਾਣੇ ਸਮੇਂ ਵਿੱਚ ਹੁੰਦੀ ਸੀ ਹੁਣ ਤਾਂ ਕਿਸਾ ਫਸਲਾਂ ਦੀ ਕਟਾਈ ਵੀ ਬਹੁਤ ਘੱਟ ਸਮੇਂ ਵਿੱਚ ਹੋ ਜਾਂਦੀ ਹੈ ਕੰਬਾਈਨ ਮਸ਼ੀਨਾਂ ਦੇ ਆਉਣ ਨਾਲ ਫਸਲਾਂ ਦੀ ਕਟਾਈ ਬਹੁਤ ਛੇਤੀ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਮੰਡੀ ਵਿੱਚ ਲੈ ਜਾਣ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਟਰਾਲੀ ਅਤੇ ਟਰੈਕਟਰ ਆਉਣ ਦੇ ਨਾਲ ਕਿਸਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਪਣੀ ਫਸਲ ਇ ਬੜੀ ਆਸਾਨੀ ਨਾਲ ਭੇਜ ਦਿੰਦੇ ਹਨ ਮੰਡੀ ਵਿੱਚ ਉਹਨਾਂ ਦੇ ਭਾਅ ਵੀ ਵਧੀਆ ਮਿਲਦੇ ਹਨ ਫਸਲਾਂ ਦੇ